ਸਤਿ ਸ਼੍ਰੀ ਅਕਾਲ ਲੋਕ ਵਿਆਹ ਵਿੱਚ ਤੋਹਫ਼ੇ ਦੀ ਪ੍ਰਥਾ ਅਤੇ ਦਾਜ ਵਿੱਚ ਕੁਝ ਕੁਝ ਫ਼ਰਕ ਹੁੰਦਾ ਹੈ ਤੋਹਫ਼ੇ ਲਗਨ ਦੀ ਰਸਮ ਵਿੱਚ ਘਰ ਦੀ ਸਮਰਿੱਧੀ ਦੀ ਖੁਸ਼ੀਆਂ ਨੂੰ ਵਧਾਉਣ ਲਈ ਹੁੰਦਾ ਹੈ ਅੱਜ ਕੱਲ੍ਹ ਲੋਕ ਲਾੜੀ ਨੂੰ ਵਿਆਹ 'ਤੇ ਕਾਫ਼ੀ ਤੋਹਫ਼ੇ ਦਿੰਦੇ ਹੈ ਜ਼ਿਆਦਾਤਰ ਲੋਕ ਸ਼ਗਨ ਪਾ ਦਿੰਦੇ ਹੈ ਜਾਂ ਘਰ ਦੀ ਸਜਾਵਟ ਲਈ ਸਮਾਨ ਦੇ ਦਿੰਦੇ ਆ ਜਾਂ ਕੱਪੜੇ ਦੇ ਦਿੰਦੇ ਆ ਜਾਂ ਕੋਈ ਵੀ ਮਹਿੰਗੀ ਚੀਜ਼ ਸ਼ਾਮਿਲ ਹੋ ਸਕਦੀ ਹੈ ਇਹਦੇ ਵਿੱਚ ਜਿਵੇਂ ਕਿ ਸੋਨਾ ਚਾਂਦੀ ਆਦਿ ਉੱਤੋਂ ਦੂਜੀ ਗੱਲ ਦਾਜ ਇੱਕ ਇੱਦਾਂ ਦੀ ਪ੍ਰਥਾ ਹੈ ਜਿਹਦੇ ਵਿੱਚ ਦੁਲਹਨ ਦੀ ਪਹਿਚਾਣ ਦੀ ਰਾਖੀ ਲਈ ਰੱਖੀ ਜਾਂਦੀ ਆ ਜਿਹਦੇ ਵਿੱਚ ਸੋਨਾ ਚਾਂਦੀ ਕੱਪੜੇ ਅਤੇ ਇੰਨੇ ਮਾਲ ਦੀ ਬਹੁਤ ਮਹਿੰਗੀ ਮਹਿੰਗੀਆਂ ਚੀਜ਼ਾਂ ਸ਼ਾਮਿਲ ਹੁੰਦੀ ਆ ਉਹ ਇੱਕ ਤਰ੍ਹਾਂ ਦਾ ਸਮਰਿਧੀਕਰਨ ਹੈ ਜੋ ਪਰਿਵਾਰ ਦੇ ਆਰਥਿਕ ਸਥਿਤੀ ਦੇ ਉੱਤੇ ਹੁੰਦਾ ਏ ਦਾਜ ਵਿੱਚ ਸਿਰਫ਼ ਦੁਲਹਨ ਦਾ ਕਿਰਾਇਆ ਦੇਖਿਆ ਜਾਂਦਾ ਕਿ ਦੁਲਹਨ ਕਿੰਨੇ ਤੋਲੇ ਤਿਲਾ ਸੋਨਾ ਸਾਡੇ ਘਰੇ ਲੈ ਕੇ ਆ ਸਕਦੀ ਹੈ ਮੇਰੇ ਖਿਆਲ ਨਾਲ਼ ਦਾਜ ਨੂੰ ਹਮੇਸ਼ਾਂ ਬੰਦ ਕਰ ਦੇਣਾ ਚਾਹੀਦਾ ਹੈ ਦਾਜ ਦੇਣਾ ਹੀ ਨਹੀਂ ਚਾਹੀਦਾ ਹੈ ਕਿਉਂਕਿ ਦਾਜ ਦੇ ਕਾਰਨ ਅੱਜ ਕਈ ਔਰਤਾਂ ਵਿਆਹ ਤੋਂ ਬਾਅਦ ਮਰ ਜਾਂਦੀਆਂ ਲੋਕ ਉਹਨਾਂ ਨੂੰ ਜਿੰਦਾ ਜਲਾ ਦਿੰਦੇ ਆ ਧੰਨਵਾਦ ਜੀ